ਸਿੱਖ ਧਰਮ ਭਾਰਤ ਦੇ ਪ੍ਰਮੁੱਖ ਧਰਮਾਂ ਦੇ ਵਿੱਚੋਂ ਇੱਕ ਮਹੱਤਵਪੂਰਨ ਧਰਮ ਆ ਅਤੇ ਸਭ ਤੋਂ ਛੋਟੀ ਉਮਰ ਦਾ ਧਰਮ ਆ ਸਭ ਤੋਂ ਛੋਟੀ ਉਮਰ ਤੋਂ ਭਾਵ ਕਿ ਇਸ ਧਰਮ ਦੀ ਜਿਹੜੀ ਸ਼ੁਰੂਆਤ ਆ ਉਹ ਸਾਢੇ ਕੁ ਪੰਜ ਸੌ ਸਾਲ ਪਹਿਲਾਂ ਹੋਈ ਇੱਕ ਤਾਂ ਇਸ ਧਰਮ ਦੇ ਜਿਹੜੇ ਬਾਨੀ ਨੇ ਉਹ ਗੁਰੂ ਨਾਨਕ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਇਹ ਨੌ ਗੁਰੂ ਸਾਹਿਬਾਨ ਦਾ ਸਫ਼ਰ ਤੈਅ ਕਰਦਾ ਹੋਇਆ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਅਤੇ ਹੁਣ ਵਰਤਮਾਨ ਸਮੇਂ ਦੇ ਜਿਹੜੇ ਸਾਡੇ ਗੁਰੂ ਨੇ ਉਹ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਅਤੇ ਦੁਨੀਆਂ ਵਿੱਚ ਇੱਕ ਵਿਲੱਖਣ ਧਰਮ ਆ ਅਤੇ ਜਿਸ ਦੇ ਵਿੱਚ ਇੱਕ ਸ਼ਬਦ ਗੁਰੂ ਨੂੰ ਗੱਦੀ ਦੇ ਕੇ ਸਿੱਖਾਂ ਦੇ ਗਿਆਰਵੇਂ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਅਤੇ ਸਿੱਖ ਧਰਮ ਦੀ ਸਭ ਤੋਂ ਵੱਡੀ ਜਿਹੜੀ ਮਹਾਨ ਮਹੱਤਵਪੂਰਨ ਵਿਸ਼ੇਸ਼ਤਾ ਉਹ ਇਹ ਆ ਕਿ ਇਸ ਦੇ ਵਿੱਚ ਹਰ ਜਾਤ ਨਸਲ ਰੰਗ ਵਰਣ ਦਾ ਜਿਹੜਾ ਵਿਅਕਤੀ ਹੈਗਾ ਉਹ ਇਸ ਵਿੱਚ ਸ਼ਾਮਿਲ ਹੋ ਸਕਦਾ ਕਿਸੇ ਵੀ ਤਰ੍ਹਾਂ ਦਾ ਜਿਹੜਾ ਵਿਤਕਰਾ ਹੈਗਾ ਉਹ ਕਿਸੇ ਨਾਲ ਭੇਦਭਾਵ ਆ ਜਿਹੜਾ ਕਿਸੇ ਵੀ ਤਰ੍ਹਾਂ ਦਾ ਕੋਈ ਭੇਦਭਾਵ ਕਿਸੇ ਵਿਅਕਤੀ ਨਾਲ ਨਹੀਂ ਕੀਤਾ ਜਾਂਦਾ ਅਤੇ ਇਹਦੇ ਵਿੱਚ ਜਿਹੜੀ ਇਕੁਅਲਟੀ ਹੈਗੀ ਇਕੁਅਲਟੀ ਇਸ ਧਰਮ ਦੇ ਵਿੱਚ ਜਿਹੜੀ ਇਹਦੀ ਮੁੱਖ ਵਿਸ਼ੇਸ਼ਤਾ ਹੈ ਕਿ ਕੋਈ ਵੱਡਾ ਛੋਟਾ ਨਹੀਂ ਹੈ ਕੋਈ ਰੰਗ ਦਾ ਕੋਈ ਨਸਲ ਦਾ ਕਿਸੇ ਤਰ੍ਹਾਂ ਦਾ ਕੋਈ ਭੇਦ ਭਾਵ ਇਸ ਧਰਮ ਦੇ ਵਿੱਚ ਨਹੀਂ ਹੈ ਅਤੇ ਹਰ ਕੋਈ ਇਸ ਦੀਆਂ ਜਿਹੜੀਆਂ ਸਿੱਖਿਆਵਾਂ ਨੇ ਹਰ ਕੋਈ ਗੁਰਬਾਣੀ ਪੜ੍ਹ ਕੇ ਗੁਰੂ ਗ੍ਰੰਥ ਸਾਹਿਬ ਜੀ ਪੜ੍ਹ ਕੇ ਉਸ ਦੇ ਵਿੱਚ ਇੱਕ ਸਿੱਖ ਧਰਮ ਦੇ ਵਿੱਚ ਸ਼ਾਮਿਲ ਹੋ ਸਕਦਾ